ਮੈਂ ਆਪਣੀ ਡਰਾਇੰਗ ਦੇ ਲਈ ਜਾਂ ਤਾਂ ਖੇਤਾਂ ਵਿੱਚ ਜਾਂਦੀ ਹਾਂ ਜਿੱਥੇ ਕਿ ਲੋਕ ਕੰਮ ਕਰਦੇ ਹਨ ਜਾਂ ਫਿਰ ਅਜਿਹੀਆਂ ਜਗ੍ਹਾ ਜਿੱਥੇ ਜਿੱਦਾਂ ਕਿ ਭੱਠਿਆਂ ਦੇ ਵਿੱਚ ਜਿੱਥੇ ਇੱਟਾਂ ਬਣਦੀਆਂ ਹਨ ਏਦਾਂ ਦੇ ਮਾਹੌਲ ਜਾਂ ਫਿਰ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਕਿਸੇ ਪਾਰਕ ਕਿਸੇ ਗਰਾਊਡ ਦੇ ਵਿੱਚ ਜਾਨੀ ਹਾਂ ਜਿੱਥੋਂ ਮੈਨੂੰ ਕੋਈ ਨਾ ਕੋਈ ਹਿੰਟ ਜਾਂ ਕੋਈ ਇਹੋ ਜਿਹੀ ਚੀਜ਼ ਮਿਲੇ ਜਿਸ ਦੇ ਅਕੋਰਡਿੰਗ ਮੈਂ ਆਪਣੀ ਡਰਾਇੰਗ ਬਣਾ ਸਕਾਂ ਅਤੇ ਆਪਣੀ ਡਰਾਇੰਗ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕਰ ਸਕਾਂ ਜਿੱਦਾਂ ਕਿ ਕਈ ਵਾਰ ਤਾਂ ਮੈਂ ਮੈਨੂੰ ਖੇਤਾਂ ਦੇ ਵਿੱਚ ਰਾਤ ਦਾ ਮਾਹੌਲ ਵੀ ਪਸੰਦ ਹੈ ਅਤੇ ਮੈਂ ਇੱਦਾਂ ਦੀਆਂ ਡਰਾਇੰਗਸ ਵੀ ਕਰਨਾ ਪਸੰਦ ਕਰਦੀ ਹਾਂ ਮੈਂ ਇਸੀ ਤਰ੍ਹਾਂ ਆਪਣੀਆਂ ਜਿਹੜੀਆਂ ਡਰਾਇੰਗਸ ਦੇ ਲਈ ਕਨਸੈਪਟ ਅਤੇ ਉਹਨਾਂ ਦੇ ਵਿੱਚ ਐਡ ਕਰਨ ਲਈ ਚੀਜ਼ਾਂ ਇਕੱਠੀਆਂ ਕਰਦੀ ਹਾਂ ਅਤੇ ਮੈਨੂੰ ਇਹਨਾਂ ਚੀਜ਼ਾਂ ਦਾ ਬਹੁਤ ਹੀ ਨਾਲ ਬਹੁਤ ਹੀ ਲਗਾਵ ਹੈ ਪਿੰਡਾਂ ਦੇ ਵਿੱਚ ਖਾਸ ਕਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ ਬੱਚੇ ਖੇਡ ਰਹੇ ਹੁੰਦੇ ਹਨ ਆਪਣੀ ਦਾਦੀ ਜਾਂ ਨਾਨੀਆਂ ਤੋਂ ਕਹਾਣੀਆਂ ਗੱਲਾਂ ਸੁਣਦੇ ਹਨ ਅਤੇ ਇੱਕ ਪਾਸੇ ਜਨਾਨੀਆਂ ਇਕੱਠੀਆਂ ਹੋ ਕੇ ਸਬਜ਼ੀ ਭਾਜੀ ਦਾ ਕਰ ਰਹੀਆਂ ਹੁੰਦੀਆਂ ਹਨ ਅਤੇ ਮਿੱਠੀ ਮਿੱਠੀ ਸ਼ਾਮ ਹੁੰਦੀ ਹੈ ਅਤੇ ਥੋੜ੍ਹੇ ਬਹੁਤੇ ਤਾਰੇ ਦਿਖਣੇ ਸ਼ੁਰੂ ਹੁੰਦੇ ਹਨ ਇਕੱਠੇ ਬੈਠਣਾ ਇਕੱਠੇ ਖੇਡਣਾ ਜਾਂ ਫਿਰ ਪਿੰਡਾਂ ਦੇ ਵਿੱਚ ਸੱਥਾਂ ਅਲੱਗ ਹੁੰਦੀਆਂ ਹਨ ਜਿੱਥੇ ਕਿ ਬਜ਼ੁਰਗ ਇਕੱਠੇ ਬੈਠ ਕੇ ਗੱਲਾਂ ਕਰਦੇ ਹਨ ਇੱਦਾਂ ਦੀਆਂ ਚੀਜ਼ਾਂ ਤੋਂ ਮੈਂ ਆਪਣੀ ਡਰਾਇੰਗ ਕਰਨਾ ਪਸੰਦ ਕਰਦੀ ਹਾਂ ਇਸ ਤਰ੍ਹਾਂ ਮੈਂ ਆਪਣੀ ਡਰਾਇੰਗ ਕਰਨ ਦੇ ਕੋਨਸੈਪਟ ਲੱਭਦੀ ਹਾਂ ਅਤੇ ਇਹ ਚੀਜ਼ਾਂ ਕਰਨ 'ਚ ਮੈਨੂੰ ਬਹੁਤ ਹੀ ਖੁਸ਼ੀ ਮਿਲਦੀ ਹੈ ਅਤੇ ਮੈਨੂੰ ਇਹ ਚੀਜ਼ਾਂ ਕਰਨੀਆਂ ਬਹੁਤ ਹੀ ਪਸੰਦ ਹਨ